ਹੈਲੋ ਹਾਂਜੀ ਗੁੱਡ ਅਫਟਰਨੂਨ ਮੈਮ ਹਾਂਜੀ ਮੈਮ ਤੁਸੀਂ ਸਪੋਰਟਸ ਕਲੱਬ ਤੋਂ ਬੋਲ ਰਹੇ ਹੋ ਮੈਮ ਹਾਂਜੀ ਮੈਮ ਮੈਂ ਇਹ ਗੱਲ ਕਰਨੀ ਸੀਗੀ ਕਿ ਮੇਰੇ ਬ੍ਰਦਰ ਹੈਗੇ ਨੇ ਤਾਂ ਅਸੀਂ ਨਾ ਮੈਮ ਖੇਡਾਂ 'ਚ ਲਾਉਣਾ ਸੀਗਾ ਕਿਉਂਕਿ ਉਹ ਘਰ ਮਤਲਬ ਕਿ ਧੁੱਪੇ ਫਿਰਦੇ ਰਹਿੰਦੇ ਹੈਗੇ ਆ ਵੀ ਅਤੇ ਬੈਠਦੇ ਨਹੀਂ ਹੈਗੇ ਤਾਂ ਤੁਹਾਡੇ ਕੋਲ ਸਾਰੀਆਂ ਖੇਡਾਂ ਉਪਲਬਧ ਨੇ ਹਾਂਜੀ ਮੈਮ ਵੀ ਜਿੱਦਾਂ ਵੀ ਖੇਡ ਹੁੰਦੀਆਂ ਨਾ ਵੀ ਜਿੱਦਾਂ ਵਾਲੀਬਾਲ ਹੋ ਗਈ ਕੋਈ ਵੀ ਹੈ ਨਾ ਵੀ ਬਸ ਉਹਨਾਂ ਨੂੰ ਅਸੀਂ ਇਹ ਵੀ ਧੁੱਪੇ ਫਿਰਦੇ ਰਹਿੰਦੇ ਹੈਗੇ ਆ ਤਾਂ ਕਰਕੇ ਇਹਨਾਂ ਨੂੰ ਥੋੜ੍ਹਾ ਜਿਹਾ ਵੀ ਬਾਕੀ ਆਪਣੇ ਕੋਲ ਬਾਕੀ ਸਾਰੇ ਪ੍ਰਬੰਧ ਹੈਗੇ ਨੇ ਹਾਂਜੀ ਮੈਮ ਅਤੇ ਆਪਣੀ ਮੰਨਥਲੀ ਫੀਸ ਕਿੰਨੀ ਹੈਗੀ ਆ ਮੈਮ ਠੀਕ ਆ ਮੈਮ ਤਾਂ ਇੱਕ ਮੈਮ ਇਹ ਪੁੱਛਣਾ ਸੀਗਾ ਵੀ ਮੰਨ ਕੇ ਚੱਲੋ ਵੀ ਟਾਈਮਿੰਗ ਕੀ ਆ ਆਪਣੀ ਖੇਡਾਂ ਦੀ ਠੀਕ ਹੈ ਜੀ ਮੈਮ ਠੀਕ ਬਾਕੀ ਮੈਮ ਮੈਂ ਇਹ ਪੁੱਛ ਹਾਂਜੀ ਮੈਮ ਹਾਂਜੀ ਮੈਮ ਜੀ ਬਾਕੀ ਜੇ ਉਹਨਾਂ ਨੂੰ ਟਾਈਮ ਟੂ ਟਾਈਮ ਵੀ ਵਧੀਆ ਖੇਡਾਂ ਹੋਣਗੀਆਂ ਹੈ ਨਾ ਤਾਂ ਸੂਟ ਵਗੈਰਾ ਵੀ ਅਸੀਂ ਠੀਕ ਹੈ ਠੀਕ ਹੈ ਜੀ ਮੈਮ ਥੈਂਕ ਯੂ ਮੈਮ